ਉੱਨੀ ਜਨਵਰੀ ਉੱਨੀ ਸੌ ਤਿਹੱਤਰ ਪੱਚੀ ਅਗਸਤ ਉੱਨੀ ਸੌ ਚੁਹੱਤਰ ਦੋ ਜੁਲਾਈ ਉੱਨੀ ਸੌ ਅੱਸੀ ਛੇ ਨਵੰਬਰ ਉੱਨੀ ਸੌ ਬਿਆਸੀ ਵੀਹ ਜਨਵਰੀ ਉੱਨੀ ਸੌ ਪਚਾਸੀ